ਅੱਜ ਦੇ ਸਮੇਂ ਵਿੱਚ ਲੋਕ ਬਹੁਤ ਬਿਜ਼ੀ ਹਨ ਅਤੇ ਉਹਨਾਂ ਕੋਲ ਬਿਲਕੁਲ ਸਮਾਂ ਨਹੀਂ ਹੈ ਕਿ ਉਹ ਆਪਣੀ ਸਿਹਤ ਪ੍ਰਤੀ ਧਿਆਨ ਦੇ ਸਕਣ ਅਜਿਹੇ ਸਮੇਂ ਵਿੱਚ ਸਾਈਕਲ ਇੱਕ ਬਹੁਤ ਵਧੀਆ ਸਾਧਨ ਹੈ ਸਾਈਕਲ ਨਾ ਕੇਵਲ ਤੁਹਾਨੂੰ ਸਮੇਂ ਸਿਰ ਪਹੁੰਚਾਉਂਦੀ ਹੈ ਬਲਕਿ ਇਸ ਰਾਹੀਂ ਤੁਸੀਂ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਦਾ ਵੀ ਧਿਆਨ ਰੱਖ ਸਕਦੇ ਹੋ ਕਈ ਵਾਰ ਸਾਈਕਲ ਚਲਾਉਣਾ ਬਹੁਤ ਹੀ ਥਕਾਵਟ ਵਾਲਾ ਕੰਮ ਹੋ ਜਾਂਦਾ ਹੈ ਕਿਉਂਕਿ ਸਾਈਕਲ ਨੂੰ ਖਿੱਚ ਕੇ ਲੈ ਕੇ ਜਾਣਾ ਪੈਂਦਾ ਹੈ ਪਰ ਇਸ ਦੇ ਨਾਲ ਨਾਲ ਤੁਹਾਡੀ ਸਿਹਤ ਕਾਫ਼ੀ ਵਧੀਆ ਬਣੀ ਰਹਿੰਦੀ ਹੈ ਜਦੋਂ ਵੀ ਮੈਂ ਲੰਬੇ ਰਸਤੇ ਲੈਂਦੀ ਹਾਂ ਜਾਂ ਫਿਰ ਮੈਨੂੰ ਕਿਤੇ ਦੂਰ ਜਾਣਾ ਹੁੰਦਾ ਹੈ ਉਦੋਂ ਮੈਂ ਆਪਣੀ ਸਕੂਟੀ ਦਾ ਇਸਤੇਮਾਲ ਕਰਦੀ ਹਾਂ ਅਤੇ ਉੱਥੇ ਮੈਂ ਬਹੁਤ ਹੀ ਸੁਚੇਤ ਅਤੇ ਬਹੁਤ ਹੀ ਧਿਆਨ ਨਾਲ ਆਪਣੀ ਸਕੂਟੀ ਚਲਾਉਂਦੀ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਸਿ ਸਿਹਤ ਤੋਂ ਵੱਧ ਕੇ ਕੁਛ ਵੀ ਨਹੀਂ ਹੈ ਅਤੇ ਆਪਣੀ ਜਾਨ ਤੋਂ ਵੱਧ ਕੇ ਕੁਛ ਵੀ ਨਹੀਂ ਹੈ ਉਸ ਸਮੇਂ ਮੈਂ ਆਪਣੀ ਸਪੀਡ ਕਦੇ ਵੀ ਵੀਹ ਤੋਂ ਵੱਧ ਨਹੀਂ ਰੱਖਦੀ ਅਤੇ ਮੈਂ ਬਹੁਤ ਹੀ ਧਿਆਨ ਰੱਖਦੀ ਹਾਂ ਕਿ ਮੈਂ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਾ ਪਹੁੰਚਾਵਾਂ ਜਾਂ ਕਿਸੇ ਵੀ ਵਸਤੂ ਨੂੰ ਨੁਕਸਾਨ ਨਾ ਪਹੁੰਚਾਵਾਂ ਅਤੇ ਮੈਂ ਬਿਲਕੁਲ ਅਲਰਟ ਹੋ ਕੇ ਬਿਲਕੁਲ ਸਤਰਕ ਹੋ ਕੇ ਆਪਣੀ ਸਕੂਟੀ ਚਲਾਉਂਦੀ ਹਾਂ ਅਤੇ ਮੋੜ ਦਾ ਬਹੁਤ ਧਿਆਨ ਰੱਖਦੇ ਹੋਏ ਮੋੜ ਦਾ ਬਹੁਤ ਧਿਆਨ ਰੱਖਦੇ ਹੋਏ ਮੈਂ ਆਪਣੀ ਸਕੂਟੀ ਕ੍ਰੋਸ ਕਰਦੀ ਹਾਂ ਅਤੇ ਇਸ ਤੋਂ ਇਲਾਵਾ ਮੈਂ ਹੋਰ ਲੋਕਾਂ ਨੂੰ ਵੀ ਸੁਚੇਤ ਕਰਦੀ ਹਾਂ ਕਿ ਉਹ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਵਾਹਨ ਚਲਾਉਣ ਭਾਵੇਂ ਉਹ ਸਾਈਕਲ ਹੋਵੇ ਭਾਵੇਂ ਉਹ ਸਕੂਟੀ ਹੋਵੇ ਭਾਵੇਂ ਮੋਟਰਸਾਈਕਲ ਹੋਵੇ ਉਹ ਟਰਾਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਅਤੇ ਡਰਾਈਵਿੰਗ ਲਾਈਸੈਂਸ ਹੋਣ ਦੇ ਬਾਵਜੂਦ ਹੀ ਕਿਸੀ ਵੀ ਤਰ੍ਹਾਂ ਦੀ ਗੱਡੀ ਚਲਾਉਣ ਅਤੇ ਉਹ ਇਹ ਧਿਆਨ ਰੱਖਣ ਕਿ ਉਹ ਆਪਣੀ ਸੁਰੱਖਿਆ ਦੇ ਨਾਲ ਨਾਲ ਦੂਜੇ ਵਿਅਕਤੀ ਦੀ ਨੂੰ ਵੀ ਨੁਕਸਾਨ ਨਾ ਪਹੁੰਚਾਉਣ ਅਤੇ ਉਹਦੀ ਸਿਹਤ ਦਾ ਅਤੇ ਉਹਦੀ ਵੀ ਸੁਰੱਖਿਆ ਦਾ ਖਿਆਲ ਰੱਖਣ